ਮੈਂ ਇਹ ਘਟਨਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੰਦਾ ਹਾਂ ਜੇ ਇਹ ਮੇਰੇ ਆਪਣੇ ਬਾਰੇ ਹੀ ਹੈ ਮੈਨੂੰ ਦੋ ਹਜ਼ਾਰ ਇੱਕੀ ਵਿੱਚ ਇਹੋ ਜਿਹੀ ਬਿਮਾਰੀ ਹੋਈ ਸੀ ਜਿਹਦਾ ਮੈਨੂੰ ਆਸ ਪਾਸ ਇਲਾਜ ਨਹੀਂ ਮਿਲ ਰਿਹਾ ਸੀਗਾ ਇਹ ਬਿਮਾਰੀ ਸੀਗੀ ਨਾ ਮੇਰੇ ਕੋਲ ਬੈਠਾ ਜਾਂਦਾ ਸੀਗਾ ਨਾ ਮੇਰੇ ਕੋਲ ਧਿਆਨ ਨਾਲ ਖੜਿਆ ਜਾਂਦਾ ਸੀਗਾ ਅਤੇ ਨਾ ਮੈਂ ਸਟੂਲ ਪਾਸ ਕਰ ਸਕਦਾ ਸੀਗਾ ਠੀਕ ਤਰ੍ਹਾਂ ਨਾਲ ਅਤੇ ਮੈਨੂੰ ਬਹੁਤ ਦਰਦ ਹੁੰਦਾ ਸੀ ਇਹ ਕਰਕੇ ਮੈਨੂੰ ਇਹ ਲੱਗਿਆ ਸੀਗਾ ਕਿ ਮੈਂ ਜ਼ਿੰਦਗੀ 'ਚ ਹੁਣ ਕੁਛ ਨਹੀਂ ਕਰ ਸਕਦਾ ਅਤੇ ਬਸ ਇੱਕ ਜਗ੍ਹਾ ਬੈਠਾ ਰਹਿ ਜੂੰਗਾ ਮੈਨੂੰ ਕ੍ਰਿਕੇਟ ਖੇਡਣ ਦਾ ਬਹੁਤ ਸ਼ੌਂਕ ਸੀਗਾ ਅਤੇ ਉਦੋਂ ਮੇਰਾ ਨੈਸ਼ਨਲ ਦੀ ਟੀਮ ਵਿੱਚ ਸਿਲੈਕਸ਼ਨ ਹੋਇਆ ਸੀਗਾ ਅਤੇ ਮੈਂ ਦੋ ਮੈਚ ਖੇਡਣੇ ਸੀ ਪਰ ਇਸ ਬਿਮਾਰੀ ਕਰਕੇ ਮੇਰਾ ਓਪ੍ਰੇਸ਼ਨ ਹੋਇਆ ਸੀਗਾ ਹਜੇ ਇੱਕ ਡੇਢ ਮਹੀਨਾ ਹੋਇਆ ਸੀਗਾ ਮੇਰੇ ਓਪ੍ਰੇਸ਼ਨ ਨੂੰ ਅਤੇ ਮੈਨੂੰ ਉੱਥੇ ਜਾ ਕੇ ਖੇਡਣਾ ਪੈਣਾ ਸੀ ਪਰ ਜਦੋ ਮੈਂ ਉੱਥੇ ਜਾ ਕੇ ਖੇਡਣ ਲੱਗਿਆ ਮੇਰੇ ਤੋਂ ਬਿਲਕੁਲ ਨਹੀਂ ਖੇਡਿਆ ਗਿਆ ਮੈਂ ਆਪਣੇ ਪੈਰ ਹੀ ਨਹੀਂ ਖੋਲ੍ਹ ਨਾ ਮੈਂ ਆਪਣੇ ਪੈਰ ਖੋਲ੍ਹ ਪਾਇਆ ਨਾ ਕੁਛ ਕਰ ਪਾਇਆ ਫਿਰ ਵੀ ਮੈਂ ਬਹੁਤ ਹਿੰਮਤ ਨਾਲ ਉਰੇ ਖੜ੍ਹਿਆ ਰਿਹਾ ਸੱਤ ਰਨ ਮਾਰੇ ਅਤੇ ਫਿਰ ਮੈਨੂੰ ਉਹ ਵੀ ਗਲਤ ਆਉਟ ਦਿੱਤਾ ਗਿਆ ਅੰਬਾਇਰ ਵਾਸਤੇ ਉਹ ਵੀ ਅੰਬਾਇਰ ਨੇ ਪੈਸੇ ਖਾਧੇ ਹੋਏ ਸਾਹਮਣੇ ਬੋਲਰ ਤੋਂ ਅਤੇ ਮੈਨੂੰ ਗਲਤ ਆਉਟ ਦਿੱਤਾ ਗਿਆ ਅਤੇ ਇਹ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕਿਤਿਓਂ ਕਿਤੋਂ ਵੀ ਬੈਸ ਬਾਊਂਸ ਬੈਕ ਕਰ ਸਕਦੇ ਹੋ ਬਸ ਤੁਹਾਨੂੰ ਮੋਟੀਵੇਸ਼ਨ ਚਾਹੀਦੀ ਹੈ ਅਤੇ ਤੁਹਾਡੇ ਅੰਦਰ ਕੁਛ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ ਅਤੇ ਤੁਸੀਂ ਕੁਛ ਵੀ ਪ੍ਰਾਪਤ ਕਰ ਸਕਦੇ ਹੋ